ਮੈਂ ਜ਼ਿਆਦਾ ਨਿਊਜ਼ ਚੈਨਲ ਜਾਂ ਖ਼ਬਰਾਂ ਵਾਲੇ ਜੋ ਚੈਨਲ ਹਨ ਉਹ ਜ਼ਿਆਦਾ ਨਹੀਂ ਦੇਖਦਾ ਅਤੇ ਖ਼ਬਰਾਂ ਦੀ ਜਾਣਕਾਰੀ ਲਈ ਮੈਂ ਜ਼ਿਆਦਾਤਰ ਅਖ਼ਬਾਰ ਦੀਆਂ ਹੈਡਲਾਈਨਜ ਉਹ ਹੀ ਪੜ੍ਹ ਲੈਂਦਾ ਹਾਂ ਜਿਵੇਂ ਕਿ ਇੰਗਲਿਸ਼ ਟ੍ਰਿਬਿਊਨ ਜਾਂ ਪੰਜਾਬੀ ਟ੍ਰਿਬਿਊਨ ਅਖ਼ਬਾਰ ਹੈ ਤਾਂ ਉਹ ਅਖ਼ਬਾਰ ਡੇਲੀ ਮੇਰੇ ਘਰ ਆਉਂਦੀ ਹੈ ਅਤੇ ਉਹਦੇ ਵਿੱਚੋਂ ਵੀ ਮੈਂ ਸਿਰਫ਼ ਕਿਉਂਕਿ ਸਮਾਂ ਘੱਟ ਹੁੰਦਾ ਹੈ ਤਾਂ ਹੈਡਲਾਈਨਜ਼ ਜੋ ਹੁੰਦੀਆਂ ਹਨ ਉਹ ਹੀ ਜ਼ਿਆਦਾ ਦੇਖਦਾ ਹਾਂ ਉਸ ਤੋਂ ਇਲਾਵਾ ਖ਼ਬਰਾਂ ਵਾਲੇ ਚੈਨਲ ਮੈਂ ਜ਼ਿਆਦਾ ਨਹੀਂ ਦੇਖਦਾ ਅਤੇ ਸਿਰਫ਼ ਇੱਕ ਜਿੱਦਾਂ ਜ਼ੀ ਬਿਜਨਸ ਚੈਨਲ ਹੈ ਜਿਹਦੇ ਵਿੱਚ ਸ਼ੇਅਰ ਮਾਰਕੀਟ ਦੇ ਨਾਲ ਸੰਬੰਧਿਤ ਖ਼ਬਰਾਂ ਹੁੰਦੀਆਂ ਹਨ ਤਾਂ ਉਹ ਮੈਂ ਜ਼ਿਆਦਾ ਦੇਖਦਾ ਅਤੇ ਉੱਥੇ ਹੀ ਕਈ ਵਾਰ ਹੈਡਲਾਈਨ ਵਾਲੀ ਪੱਟੀ ਹੇਠਾਂ ਉਸਦੇ ਚੱਲਦੀ ਹੁੰਦੀ ਹੈ ਅਤੇ ਉੱਥੋਂ ਜੋ ਖ਼ਾਸ ਖ਼ਬਰਾਂ ਹੁੰਦੀਆਂ ਹਨ ਤਾਂ ਉਹ ਦੇਖਣ ਨੂੰ ਮਿਲ ਜਾਂਦੀਆਂ ਹਨ ਤਾਂ ਕੋਈ ਖ਼ਾਸ ਚੈਨਲ ਜੋ ਖ਼ਬਰਾਂ ਵਾਲੇ ਹਨ ਉਹਨਾਂ ਨੂੰ ਮੈਂ ਬਹੁਤ ਜ਼ਿਆਦਾ ਨਹੀਂ ਦੇਖਦਾ